ਹਾਂਜੀ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਜਿਸ ਨਾਲ ਬੱਚਿਆਂ ਬੱਚਿਆਂ ਦੀ ਨੌਲੇਜ ਨੂੰ ਵਧਾਇਆ ਜਾ ਸਕਦਾ ਹੈ ਉਨ੍ਹਾਂ ਨੂੰ ਬੈਂਕ ਦੇ ਨਾਲ ਜਾਣੂ ਕਰਵਾਇਆ ਜਾ ਸਕਦਾ ਹੈ ਨਵੀਂ ਨਵੀਂ ਨੀਤੀਆਂ ਅਤੇ ਕਰਜ਼ਿਆਂ ਸੰਬੰਧੀ ਕੋਈ ਚੀਜ਼ਾਂ ਦੇ ਨਾਲ ਜਾਣੂ ਕਰਵਾਇਆ ਜਾਂਦਾ ਹੈ ਅਤੇ ਟੈਕਸ ਕਿਵੇਂ ਭਰਨਾ ਹੈ ਉਸ ਨੂੰ ਉਸ ਨਾਲ ਜਾਣੂ ਕਰਵਾਇਆ ਜਾਂਦਾ ਹੈ ਮੈਨੂੰ ਲੱਗਦਾ ਹੈ ਇਸ ਨੂੰ ਸਿਖਾਉਣ ਦੀ ਜ਼ਰੂਰਤ ਹੈ ਪਰ ਦੂਜੇ ਪਾਸੇ ਬੱਚੇ ਕਿਉਂਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਜ਼ਿਆਦਾਤਰ ਫੋਨਾਂ 'ਤੇ ਬੱਚੇ ਗੇਮਾਂ ਹੀ ਖੇਲਦੇ ਹਨ ਜੇਕਰ ਇਹ ਸਕੂਲ ਵਿੱਚ ਕੋਈ ਇਹ ਸਿਲੇਬਸ ਦਾ ਪਾਟ ਹੋਣਗੇ ਤਾਂ ਬੱਚੇ ਉਸ ਨੂੰ ਜ਼ਰੂਰ ਪੜ੍ਹਨਗੇ ਅਤੇ ਉਸ ਬੁੱਕ ਤੋਂ ਇਹ ਨੌਲੇਜ ਨੂੰ ਪ੍ਰਾਪਤ ਕਰ ਸਕਣਗੇ ਇਹ ਉਨ੍ਹਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਗਿਆ ਜਾਵੇਗਾ